ਸ਼੍ਰੀ ਮੈਂ ਪਠਾਨਕੋਟ ਤੋਂ ਰਹਿਣ ਵਾਲਾ ਹੈਗਾਂ ਅਤੇ ਮੇਰਾ ਨਾਮ ਅਠਮੀਜ਼ ਹੈਗਾ ਅਤੇ ਜਿਹੜੇ ਖੇਡ ਜਿੱਦਾਂ ਕਿ ਗੱਲ ਕਰੀਏ ਕਿ ਖੇਡਾਂ ਖੇਡਾਂ ਖੇਡਣੀਆਂ ਮੈਨੂੰ ਬਹੁਤ ਹੀ ਪਸੰਦ ਹੈਗੀਆਂ ਨੇ ਜਿੱਦਾਂ ਕਿ ਅਸੀਂ ਗੱਲ ਕਰੀਏ ਕਿ ਕ੍ਰਿਕਟ ਵਾਲੀਬਾਲ ਹਾਕੀ ਫੁੱਟਬੋਲ ਹੋਰ ਵੀ ਜਿਹੜੀਆਂ ਖੇਡਾਂ ਹੈਗੀਆਂ ਨੇ ਇਹ ਮੈਂ ਖੇਡਦਾ ਹੈਗਾਂ ਅਤੇ ਜਿਹੜੀ ਇਹਦੇ ਵਿੱਚ ਮੈਂ ਪਲੱਸ ਟੂ ਤੱਕ ਮੈਂ ਇਹ ਖੇਡਾਂ ਖੇਡੀਆਂ ਹੈਗੀਆਂ ਅਤੇ ਇਹ ਮੈਂ ਹੁਣ ਵੀ ਖੇਡਦਾ ਹੈਗਾਂ ਅਤੇ ਮੈਨੂੰ ਜਿਹੜੀ ਇਹਦੇ ਵਿੱਚ ਜਿਹੜੀ ਮੈਨੂੰ ਸੱਭ ਤੋਂ ਜ਼ਿਆਦਾ ਜਿਹੜੀ ਮਨਪਸੰਦ ਦੀ ਖੇਡ ਹੈਗੀ ਹੈ ਇਹ ਕ੍ਰਿਕਟ ਹੈਗੀ ਹੈ ਅਤੇ ਇਹ ਕ੍ਰਿਕਟ ਇਸ ਕਰਕੇ ਹੈਗੀ ਹੈ ਕਿਉਂਕਿ ਇਹ ਮੈਨੂੰ ਜ਼ਿਆਦਾ ਬਹੁਤ ਬਹੁਤ ਹੀ ਪਸੰਦ ਹੈਗੀ ਹੈ ਕਿਉਂਕਿ ਦੇਖਣਾ ਤਾਂ ਮੈਨੂੰ ਪਸੰਦ ਹੈਗੀ ਹੈਗੀ ਹੈ ਅਤੇ ਮੈਨੂੰ ਖੇਡਣਾ ਵੀ ਬਹੁਤ ਪਸੰਦ ਹੈਗੀ ਹੈ ਅਤੇ ਜਿੱਦਾਂ ਕਿ ਅਸੀਂ ਕ੍ਰਿਕਟ ਦੀ ਗੱਲ ਕਰੀਏ ਕਿ ਹੁਣ ਆਈ ਪੀ ਐਲ ਚੱਲ ਰਿਹਾ ਆਈ ਪੀ ਐਲ ਵੀ ਮੈਂ ਦੇਖਦਾ ਹੈਗਾ ਵਾ ਉਹ ਆਈ ਪੀ ਐਲ ਹੁਣ ਟੀ ਟਵੰਟੀ ਵਲਡ ਕੱਪ ਇਹ ਮੈਨੂੰ ਬਹੁਤ ਹੀ ਪਸੰਦ ਹੈਗੇ ਦੇ ਅਤੇ ਜਿਹੜੇ ਅਤੇ ਕ੍ਰਿਕਟ ਕ੍ਰਿਕਟ ਵਿੱਚ ਜਿੱਦਾਂ ਕਿ ਪਿੰਡ ਵਿੱਚ ਜਿੱਦਾਂ ਵਧੀਆ ਤਰ੍ਹਾਂ ਦਾ ਖੇਡਦੇ ਹੈਗੇ ਹਾਂ ਕੋਈ ਬੱਚੇ ਪੈਸੇ ਲਗਾਉਂਦੇ ਹੈਗੇ ਆ ਜਾਂ ਇੱਦਾਂ ਹੀ ਵਗੈਰਾ ਵਗੈਰਾ ਅਤੇ ਤਾਂ ਕਰਕੇ ਮੈਨੂੰ ਇਹ ਚੀਜ਼ਾਂ ਬਹੁਤ ਪਸੰਦ ਨੇ ਕਿ ਬੰਦਾ ਆਰਾਮ ਨਾਲ ਫਿੱਟਨੈੱਸ ਵੀ ਹੁੰਦੀ ਹੈਗੀ ਹੈ ਅਤੇ ਬੰਦਾ ਫਿੱਟ ਵੀ ਰਹਿੰਦਾ ਹੈਗਾ ਕਿ ਸਾਹ ਦੀ ਪ੍ਰੋਬਲਮ ਨਹੀਂ ਹੁੰਦੀ ਅਤੇ ਤਾਂ ਕਰਕੇ ਤਾਂ ਕਰਕੇ ਜਿਹੜੀਆਂ ਖੇਡਾਂ ਹੈਗੀਆਂ ਸਾਨੂੰ ਖੇਡਦੇ ਰਹਿਣਾ ਚਾਈਦਾ ਅਤੇ ਇਹ ਸਾਨੂੰ ਜੀਵਨ ਵਿੱਚ ਬਣਾਈ ਰੱਖਦੀਆਂ ਹਨ ਅਤੇ ਤਾਂ ਕਰਕੇ ਇਹ ਕ੍ਰਿਕੇਟ ਮੈਨੂੰ ਬਹੁਤ ਪਸੰਦ ਹੈਗੀ ਆ ਹੋਰ ਵੀ ਮੈਂ ਕਈ ਖੇਡਾਂ ਖੇਡਦਾ ਹੈਗੀਆਂ ਪਰ ਜਿਹੜੀ ਕ੍ਰਿਕੇਟ ਹੈਗੀ ਹੈ ਇਹ ਮੇਰੀ ਮੰਨ ਪਸੰਦੀ ਖੇਡ ਹੈਗੀ ਹੈ ਅਤੇ ਅਸੀਂ ਇਹ ਇਹ ਵੀ ਮਨਪਸੰਦ ਹੈਗੀ ਹੈ ਕਿ ਇਹ ਕ੍ਰਿਕਟ ਖੇਡਣੀ ਹੁੰਦੀ ਹੈ ਅਤੇ ਅਸੀਂ ਐਤਵਾਰ ਅਸੀਂ ਸਾਢੇ ਛੇ ਵਜੇ ਉੱਠ ਕੇ ਚੱਲ ਜਾਂਦੇ ਹੈਗੇ ਹਾਂ ਖੇਡਣ ਲਈ ਅਤੇ ਜਦੋਂ ਕਿਤੇ ਸਕੂਲ ਜਾਣਾ ਹੁੰਦਾ ਤਾਂ ਅਸੀਂ ਫਿਰ ਤਾਂ ਅੱਠ ਅੱਠ ਨੌਂ ਵਜੇ ਤੱਕ ਉੱਠਦੇ ਨਹੀਂ ਹੈਗੇ ਸਾਨੂੰ ਬੜਾ ਅਸੀਂ ਬੜੇ ਔਖੇ ਖੇਡਦੇ ਹੈ ਜਦੋਂ ਸਾਨੂੰ ਪਤਾ ਲੱਗਦਾ ਕਿ ਕੋਈ ਕ੍ਰਿਕੇਟ ਖੇਡ ਜਾਣਾ ਜਾਂ ਕੋਈ ਵੀ ਕੋਈ ਟੂਰਨਾਮੈਂਟ ਜਾਂ ਕੁਛ ਖੇਡਣ ਜਾਣਾ ਤਾਂ ਅਸੀਂ ਬੜੀ ਹੀ ਜਲਦੀ ਉੱਠ ਜਾਂਦੇ ਹੈ ਕਿ ਅਕਸਾਈਡ ਹੁੰਦੇ ਹਾਂ ਕਿ ਅਸੀਂ ਅੱਜ ਇਹ ਖੇਡ ਖੇਡਣੀ ਹੈ ਜਾਂ ਇੱਦਾਂ ਖੇਡਣੀ ਹੈ ਤਾਂ ਕਰਕੇ ਅਸੀਂ ਉਹਦੇ ਲਈ ਬੜੇ ਹੀ ਉਹ ਹੁੰਦੇ ਹਾਂ ਖੁਸ਼ ਹੁੰਦੇ ਹੈ ਕਿ ਅੱਜ ਅਸੀਂ ਇਹ ਕ੍ਰਿਕਟ ਖੇਲਣ ਜਾਣਾ ਹੈ ਤਾਂ ਕਰਕੇ ਇਹ ਹੀ ਮੈਨੂੰ ਚੀਜ਼ਾਂ ਪਸੰਦ ਹੈਗੀਆਂ ਅਤੇ ਧੰਨਵਾਦ